ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਅਸੀਂ ਨਾ ਚੰਡੀਗੜ੍ਹ ਤੋਂ ਇੱਥੇ ਆ ਕਲੋਨੀ 'ਚ ਨਵੇਂ ਰਹਿਣ ਆਏ ਹਾਂ ਤੁਹਾਡੇ ਗੁਆਂਢੀ ਹਾਂ ਇੱਕ ਤਰ੍ਹਾਂ ਦੇ ਅਤੇ ਮੈਨੂੰ ਨਾ ਮੇਰੀ ਫਰੈਂਡ ਨੇ ਤੁਹਾਡਾ ਨੰਬਰ ਦਿੱਤਾ ਸੀ ਜੈਸਮੀਨ ਨੇ ਅਤੇ ਹਾਂਜੀ ਅਸੀਂ ਉਹ ਦੁੱਧ ਵਗੈਰਾ ਤੁਸੀਂ ਕਿੱਥੋਂ ਲੈਂਦੇ ਆ ਅਸੀਂ ਉਹ ਪਤਾ ਕਰਨਾ ਸੀਗਾ ਅਸੀਂ ਵੀ ਲੈਣਾ ਸੀਗਾ ਓਥੋਂ ਅੱਛਾ ਠੀਕ ਆ ਉਹ ਦੁੱਧ ਵਗੈਰਾ ਵਧੀਆ ਹੁੰਦਾ ਉਹਨਾਂ ਦਾ ਇੱਦਾਂ ਅਸੀਂ ਮੱਝ ਦਾ ਲੈਣਾ ਆ ਅਤੇ ਉਹ ਕਿੰਨੇ ਰੁਪਏ ਕਿੱਲੋ ਮਿਲਦਾ ਵੈਸੇ ਅੱਛਾ ਠੀਕ ਹੈ ਨਹੀਂ ਮੱਝ ਦਾ ਹੀ ਲੈਣਾ ਸੀ ਅਸੀਂ ਫਿਰ ਵੈਸੇ ਇੱਕ ਸਾਡੇ ਜਿਹੜੇ ਪਹਿਲਾਂ ਦੁੱਧ ਵਾਲਾ ਆਉਂਦਾ ਸੀ ਨਾ ਉਹ ਸਾਨੂੰ ਘਰ ਆ ਕੇ ਪਾ ਜਾਂਦਾ ਹੁੰਦਾ ਸੀ ਦੁੱਧ ਅੱਛਾ ਠੀਕ ਆ ਠੀਕ ਆ ਫਿਰ ਮੈਨੂੰ ਨਾਲ ਲੈ ਜਿਉ ਮੈਂ ਆ ਜੂੰਗੀ ਹੈ ਨਾ ਉੱਥੇ ਤੁਹਾਡੇ ਘਰ ਕੋਲ ਠੀਕ ਏ ਅੱਛਾ ਅਛ ਅੱਛਾ ਠੀਕ ਆ ਫਿਰ ਦਹੀਂ ਵਗੈਰਾ ਸਹੀ ਹੁੰਦਾ ਇੱਦਾਂ ਖੱਟਾ ਤਾਂ ਨਹੀਂ ਹੁੰਦਾ ਨਾ ਦਹੀਂ ਅੱਛਾ ਫਿਰ ਠੀਕ ਆ ਜਦੋਂ ਵਧੀਆ ਚੀਜ਼ ਮਿਲ ਜਾਵੇ ਨਾ ਜਿੱਦਾਂ ਹੁਣ ਅਸੀਂ ਉੱਥੋਂ ਆਏ ਸਾਨੂੰ ਥੋੜ੍ਹਾ ਪਤਾ ਨਹੀਂ ਹੈਗਾ ਇੱਥੇ ਦਾ ਠੀਕ ਹੈ ਓਕੇ